ਪੰਜਾਬੀ ਭਾਸ਼ਾ ਵਿੱਚ ਹਰੇਕ ਗੱਲ ਬਾਤ ਵਿੱਚ ਇੱਕ ਜਾਂ ਦੋ ਮੁਹਾਵਰੇ ਵਰਤੇ ਜਾਂਦੇ ਹਨ ਇਹ ਪੰਜਾਬੀ ਭਾਸ਼ਾ ਦੀ ਖ਼ਾਸੀਅਤ ਹੈ ਜਿਵੇਂ ਕਿ ਉਦਾਹਰਨ ਵਜੋਂ ਅਸੀਂ ਕਿਸੇ ਨੂੰ ਉੱਲੂ ਬਣਾਉਣਾ ਜਾਂ ਆਪਾਂ ਕਿਸੇ ਨੂੰ ਮੂਰਖ ਬਣਾਉਣਾ ਕਹਿ ਦਿੰਦੇ ਹਾਂ ਜਿਵੇਂ ਕਿ ਪੰਜਾਬ ਵਿੱਚ ਕਿਸੇ ਨਾਲ ਕੋਈ ਝੇੜ ਕਰ ਦਿੰਦਾ ਹੈ ਜਾਂ ਉਸ ਨੂੰ ਕੋਈ ਗਲਤ ਰਾਹ ਪਾ ਦਿੰਦਾ ਹੈ ਤਾਂ ਆਪਾਂ ਉਸ ਨੂੰ ਮੂਰਖ ਬਣਾਉਣਾ ਜਾਂ ਉੱਲੂ ਬਣਾਉਣਾ ਵੀ ਕਹਿ ਦਿੰਦੇ ਹਾਂ ਅਤੇ ਜਿਵੇਂ ਕਿ ਅ ਬੱਚਿਆਂ ਦਾ ਸਕੂਲ ਵਿੱਚੋਂ ਰਿਜ਼ਲਟ ਆਉਂਦਾ ਹੈ ਤਾਂ ਬੱਚੇ ਕਹਿ ਦਿੰਦੇ ਨੇ ਵੀ ਮੇਰਾ ਤਾਂ ਇੱਕ ਅੱਧੇ ਨੰਬਰ ਦਾ ਹੀ ਫਰਕ ਹੈ ਤਾਂ ਉਸ ਨੂੰ ਆਪਾਂ ਉੱਨੀ ਇੱਕੀ ਦਾ ਫਰਕ ਕਹਿ ਦਿੰਦੇ ਹਾਂ ਜਾਂ ਕਹਿ ਦਿੰਦੇ ਹਾਂ ਵੀ ਥੋੜ੍ਹਾ ਜਿਹਾ ਹੀ ਫਰਕ ਹੈ ਅਤੇ ਜਾਂ ਜਿਵੇਂ ਆਪਾਂ ਕਿਸੇ ਨਾਲ ਪਿੰਡ ਵਿੱਚ ਲੜ ਪੈਂਦੇ ਹਾਂ ਤਾਂ ਆਪਣੀਆਂ ਉਹ ਅੱਖਾਂ ਵਿੱਚ ਰੜਕਣ ਲੱਗ ਜਾਂਦਾ ਹੈ ਤੋ ਉਸ ਨੂੰ ਆਪਾਂ ਉਹ ਆਪਾਂ ਨੂੰ ਬਹੁਤ ਹੀ ਜ਼ਿਆਦਾ ਭੈੜਾ ਲੱਗਦਾ ਹੈ ਤੋ ਉਸ ਨੂੰ ਆਪਾਂ ਕਹਿ ਦਿੰਦੇ ਹਾਂ ਵੀ ਇਹ ਮੇਰੀਆਂ ਅੱਖਾਂ ਵਿੱਚ ਰੜਕਦਾ ਹੈ ਜਿਵੇਂ ਕਿ ਹੁਣ ਗਰਮੀ ਦਾ ਟਾਈਮ ਚੱਲੀ ਜਾਂਦਾ ਹੈ ਅਤੇ ਬਹੁਤ ਹੀ ਜ਼ਿਆਦਾ ਗਰਮੀ ਆ ਇਸ ਲਈ ਆਪ ਆਪਾਂ ਕਹਿ ਦਿੰਦੇ ਹਾਂ ਵੀ ਅੱਗ ਵਰਦੀ ਆ ਜਮਾਂ ਅਤੇ ਇਸ ਨੂੰ ਇਸ ਨੂੰ ਜੇ ਆਪਾਂ ਦੂਜੁ ਵਰਤ ਗਏ ਤਾਂ ਦੂਜੁ ਬਰਤਨ ਵਿੱਚ ਐਂ ਲੱਗਦਾ ਹੈ ਕਿ ਬਹੁਤ ਹੀ ਜ਼ਿਆਦਾ ਗਰਮੀ ਹੈ ਇਸ ਨੂੰ ਮੁਹਾਵਰੇ ਤੌਰ 'ਤੇ ਐਂ ਵਰਤਿਆ ਜਾਂਦਾ ਹੈ ਕਿ ਅੱਗ ਵਰਦੀ ਆ ਅਤੇ ਇੱਕ ਉਦਾਹਰਨ ਹੋਰ ਵੀ ਜਿਵੇਂ ਆਪਾਂ ਕਿਸੇ ਨੂੰ ਕਹਿ ਦਿੰਦੇ ਹਾਂ ਵੀ ਜਿਵੇਂ ਕੋਈ ਬੰਦਾ ਜਾਂ ਬੱਚਾ ਪੜ੍ਹਾਈ ਵਿੱਚ ਬਹੁਤ ਹੀ ਜ਼ਿਆਦਾ ਨਲਾਇਕ ਆ ਤੇ ਆਪਾਂ ਕਹਿ ਦਿੰਦੇ ਹਾਂ ਵੀ ਇਹਨੂੰ ਜਮਾਂ ਨਿੱਲ ਆ ਇਹਨੂੰ ਕੁਛ ਵੀ ਨਹੀਂ ਆਉਂਦਾ ਪੜ੍ਹਾਈ ਵਿੱਚੋਂ ਤਾਂ ਉਸ ਨੂੰ ਆਪਾਂ ਮੁਹਾਵਰੇ ਤੌਰ 'ਤੇ ਕਹਿ ਦਿੰਦੇ ਹਾਂ ੳ ਅ ਨਾ ਆਉਣਾ ਵੀ ਬਹੁਤ ਗਿਆਨ ਨਾ ਹੋਣਾ ਗਿਆਨ ਦੀ ਕਮੀ ਹੋਣੀ ਅਤੇ ਤਾਂ ਕਰਕੇ ਇਹ ਪੰਜਾਬ ਦੀ ਖ਼ਾਸੀਅਤ ਆ ਵਿਕਾਸ ਆ ਕਿ ਹਰੇਕ ਗੱਲ ਬਾਤ ਵਿੱਚ ਮੁਹਾਵਰੇ ਵਰਤੇ ਜਾਂਦੇ ਹਨ